ਭੰਗੜਾ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਪੰਜਾਬੀ ਸੱਭਿਆਚਾਰ ਅਤੇ ਭੰਗੜੇ ਨੂੰ ਕਦੇ ਵੀ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਵੱਖ ਹੋਣ ਬਾਰੇ ਸੋਚਿਆ ਜਾ ਸਕਦਾ ਹੈ ਜਿੱਥੇ ਪੰਜਾਬੀ ਸੱਭਿਆਚਾਰ ਹੈ ਉੱਥੇ ਪੰਜਾਬੀ ਭੰਗੜਾ ਪੰਜਾਬ ਵਿੱਚ ਭੰਗੜਾ ਪੰਜਾਬ ਦਾ ਇੱਕ ਲੋਕ ਨਾਚ ਹੈ ਜੋ ਬਹੁਤ ਹੀ ਪ੍ਰਸਿੱਧ ਹੈ ਪੰਜਾਬ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਕੋਈ ਜਸ਼ਨ ਕੋਈ ਵੋਟਾਂ 'ਚ ਜਿੱਤ ਕੇ ਆਉਂਦਾ ਜਾਂ ਕੋਈ ਜਿੱਤ ਦੀ ਖੁਸ਼ੀ ਮਨਾਉਂਦਾ ਜਾਂ ਕੋਈ ਵੀ ਖੁਸ਼ੀ ਦਾ ਸਮਾਗਮ ਕੀਤਾ ਜਾਂਦਾ ਹੈ ਤਾਂ ਉਹ ਭੰਗੜੇ ਤੋਂ ਬਿਨਾਂ ਅਧੂਰਾ ਹੈ ਪੰਜਾਬ ਦੇ ਵਿੱਚ ਤਿਉਹਾਰਾਂ ਦੇ ਵਿੱਚ ਭੰਗੜਾ ਪ੍ਰੋਗਰਾਮਾਂ ਵਿੱਚ ਭੰਗੜਾ ਵਿਆਹ 'ਚ ਭੰਗੜਾ ਖੁਸ਼ੀ 'ਚ ਭੰਗੜਾ ਜਿੱਤ ਵਿੱਚ ਭੰਗੜਾ ਭੰਗੜੇ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਬਿਨਾਂ ਭੰਗੜਾ ਦੋਨਾਂ ਦਾ ਨਾਂ ਨਹੀਂ ਲਿਆ ਜਾ ਸਕਦਾ ਭੰਗੜਾ ਇੱਕ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜਿਸ ਨੂੰ ਪੰਜਾਬੀ ਸੱਭਿਆਚਾਰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ ਜਦੋਂ ਵੀ ਲੋਕ ਖੁਸ਼ੀ ਮਨਾਉਂਦੇ ਨੇ ਜਾਂ ਖੁਸ਼ੀ ਦਾ ਟਾਈਮ ਹੁੰਦਾ ਜਾਂ ਖੁਸ਼ੀ ਦਾ ਇਜ਼ਹਾਰ ਕਰਨਾ ਹੁੰਦਾ ਤਾਂ ਉਹ ਖੁਸ਼ੀ ਵਿੱਚ ਝੂੰਮਣ ਲੱਗਦੇ ਨੇ ਨੱਚਦੇ ਨੇ ਟੱਪਦੇ ਨੇ ਕਹਿ ਸਕਦੇ ਹੋ ਵੀ ਪੰਜਾਬ ਭੰਗੜਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਆਂ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ ਧੰਨਵਾਦ